ਮੈਨੂੰ ਸਟੈਂਪ ਅਤੇ ਸਿੱਕੇ ਇਕੱਠੇ ਕਰਨ ਵਿੱਚ ਬਹੁਤ ਦਿਲਚਸਪੀ ਹੈ ਇਹ ਸਭ ਮੈਂ ਬਚਪਨ ਤੋਂ ਕਰਦੀ ਆ ਰਹੀ ਹਾਂ ਮੈਂ ਆਪਣੀ ਮਾਂ ਨੂੰ ਇੱਦਾਂ ਕਰਦੇ ਦੇਖਿਆ ਸੀ ਇਹ ਚੀਜ਼ ਮੈਂ ਉਹਨਾਂ ਤੋਂ ਸਿੱਖੀ ਹੈ ਮੇਰੀ ਮਾਂ ਵੀ ਮੇਰੀ ਮਾਸੀਆਂ ਵੱਲੋਂ ਦਿੱਤੇ ਗਏ ਵਿਦੇਸ਼ੀ ਸਿੱਕੇ ਇਕੱਠੇ ਕਰਕੇ ਰੱਖਦੀ ਸੀ ਅਤੇ ਸੰਭਾਲ ਕੇ ਰੱਖਦੀ ਸੀ ਮੇਰਾ ਪਹਿਲਾ ਸਿੱਕਾ ਮੇਰੀ ਵਿਦੇਸ਼ ਗਈ ਮਾਸੀ ਵੱਲੋਂ ਦਿੱਤਾ ਗਿਆ ਹੈ ਉਹਨੂੰ ਮੈਂ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਉਸ ਨਾਲ ਮੇਰੀ ਕਾਫੀ ਯਾਦਾਂ ਵੀ ਜੁੜੀਆਂ ਨੇ ਫਿਰ ਮੇਰੇ ਜੋ ਦੋਸਤ ਮਿੱਤਰ ਅਲੱਗ ਅਲੱਗ ਵਿਦੇਸ਼ ਘੁੰਮ ਕੇ ਆਉਂਦੇ ਨੇ ਉਹ ਵੀ ਮੈਨੂੰ ਹਰ ਅਲੱਗ ਵਿਦੇਸ਼ ਦਾ ਸਿੱਕਾ ਦਿੰਦੇ ਨੇ ਉਹ ਵੀ ਮੈਂ ਸਾਂਭ ਕੇ ਰੱਖਦੀ ਹਾਂ ਇਹਨਾਂ ਤੋਂ ਸਾਨੂੰ ਹਰ ਇੱਕ ਵਿਦੇਸ਼ ਦੇ ਸਿੱਕੇ ਦੀ ਪਹਿਚਾਣ ਵੀ ਰਹਿੰਦੀ ਹੈ ਅਤੇ ਇਹਨਾਂ ਵਿੱਚੋਂ ਦੋਸਤਾਂ ਮਿੱਤਰਾਂ ਦਾ ਪਿਆਰ ਵੀ ਦਿੱਸਦਾ ਹੈ